ਹਾਂਜੀ ਮੈਂ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪੋਸਟ ਕਰਦਾ ਹਾਂ ਜਿਵੇਂ ਕਿ ਫੇਸਬੁੱਕ ਇੰਸਟਾਗਰਾਮ ਯੂਟਿਊਬ ਹੈ ਐਸ ਏ ਮੋਟੀਵੇਸ਼ਨਲ ਸਪੀਕਰ ਮੈਂ ਇਹਨਾਂ 'ਤੇ ਆਪਣੀ ਆਈ ਡੀ ਬਣਾਈ ਹੋਈ ਹੈ ਫੇਸਬੁੱਕ 'ਤੇ ਇੰਸਟਾਗਰਾਮ 'ਤੇ ਐਂਡ ਲੋਕਾਂ ਨੂੰ ਮੈਂ ਚੰਗੀ ਸੇਧ ਦੇਣ ਵਾਸਤੇ ਜਿੰਨਾ ਕੁ ਪਰਮੇਸ਼ਰ ਵੱਲੋਂ ਗਿਆਨ ਹਾਸਿਲ ਹੋਇਆ ਹੈ ਉਹ ਹੋਰ ਨਾ ਜਿਵੇਂ ਦੀ ਵੀ ਸਮਝ ਵਿੱਚ ਆਵੇ ਉਸ ਵਾਸਤੇ ਮੈਂ ਆਪਣੇ ਹਾਵ ਭਾਵ ਆਪਣੀ ਜਿੰਨੀ ਕੁ ਸਮਝ ਹੈ ਹੋਰਨਾਂ ਜੀਵਾਂ ਤੱਕ ਵੀ ਪਹੁੰਚੇ ਮੈਂ ਉਸ ਵਾਸਤੇ ਇਹਨਾਂ ਸੋਸ਼ਲ ਸਾਈਟ ਦਾ ਇਸਤੇਮਾਲ ਕਰਦਾ ਹਾਂ ਜਿਵੇਂ ਫੇਸਬੁੱਕ 'ਤੇ ਵੀ ਕੁੱਛ ਚੰਗੇ ਵਿਚਾਰ ਪਾਏ ਜਾਂਦੇ ਨੇ ਇੰਸਟਾਗਰਾਮ 'ਤੇ ਵੀ ਥੋੜ੍ਹੇ ਚੰਗੇ ਵਿਚਾਰ ਪਾਏ ਜਾਂਦੇ ਨੇ ਯੂਟਿਊਬ 'ਤੇ ਵੀ ਚੰਗੀ ਵੀਡੀਓ ਬਣਾ ਕੇ ਮੈਂ ਅਪਲੋਡ ਕਰਦਾ ਹਾਂ ਤਾਂ ਜੋ ਹੋਰ ਜੀਵ ਵੀ ਮੇਰੇ ਵਿਚਾਰਾਂ ਦੇ ਨਾਲ ਮੇਰੀ ਸੋਚ ਦੇ ਨਾਲ ਸਹਿਮਤ ਹੋ ਕੇ ਇੱਕ ਚੰਗਾ ਜੀਵਨ ਬਣਾ ਸਕਣ ਜੀ